ਪੰਜਾਬ ਵਿੱਚ ਵੱਖ ਵੱਖ ਸ ਭਾਈਚਾਰੇ ਸੱਭਿਆਚਾਰ ਰਹਿੰਦੇ ਹਨ ਪੰਜਾਬ ਦੇ ਇਹ ਸੱਭਿਆਚਾਰ ਵੱਖ ਵੱਖ ਭਾਈਚਾਰੇ ਬਹੁਤ ਹੀ ਰਲ਼ ਮਿਲ ਕੇ ਰਹਿੰਦੇ ਹਨ ਇੱਥੇ ਦੇ ਰਹਿਣ ਵਾਲੇ ਲੋਕਵਾਸੀ ਪੰਜਾਬ ਦਾ ਬਹੁ ਇਹ ਭੰਗੜਾ ਗਿੱਧਾ ਬਹੁਤ ਹੀ ਪਸੰਦ ਕਰਦੇ ਹਨ ਇਹ ਵੱਖ ਵੱਖ ਭਾਈਚਾਰੇ ਸੱਭਿਆਚਾਰ ਸੱਭਿਆਚਾਰ ਵਾਲੇ ਲੋਕ ਲੋਕ ਡਾਂਸ ਸਿੰਗਿੰਗ ਮਿਊਜ਼ਿਕ ਇਹ ਸਭ ਕੁਛ ਬਹੁਤ ਹੀ ਪਸੰਦ ਕਰਦੇ ਹਨ ਪਸੰਦ ਕਰਦੇ ਹਨ ਸਾਨੂੰ ਇਹ ਦੇਖ ਕੇ ਬਹੁਤ ਹੀ ਵਧੀਆ ਲੱਗਦਾ ਹੈ ਇਸ ਪਿੰਡ ਵਾਸੀਆਂ ਵਾਲੇ ਬਹੁਤ ਹੀ ਅਮੀਰ ਹੁੰਦੇ ਹਨ ਅਮੀਰ ਨਿਵਾਸੀਆਂ ਵਾਲੇ ਹਨ ਸਨ ਇਹ ਭਾਈਚਾਰ ਸੱਭਿਆਚਾਰ ਵਾਲੇ ਬਹੁਤ ਹੀ ਚੰਗੇ ਇਨਸਾਨ ਹੁੰਦੇ ਹਨ ਅਤੇ ਰਲ਼ ਮਿਲ ਕੇ ਰਹਿੰਦੇ ਹਨ